ਮੈਂ ਕੋਈ ਵੀ ਚਿੱਤਰਕਾਰੀ ਕੈਂਨਵਸ 'ਤੇ ਬਣਾਉਣ ਤੋਂ ਪਹਿਲਾਂ ਸੋਚਦੀ ਹਾਂ ਵੀ ਕੀ ਬਣਾਉਣਾ ਹੈ ਉਸ ਤੋਂ ਬਾਅਦ ਮੈਂ ਪੈਨਸਿਲ ਦੇ ਨਾਲ ਉਸਨੂੰ ਕੈਂਨਵਸ 'ਤੇ ਬਣਾਉਦੀ ਹਾਂ ਅਤੇ ਰੰਗਾਂ ਦੇ ਨਾਲ ਆਪਣੀ ਭਾ ਭਾਵਨਾਵਾਂ ਨੂੰ ਦੱਸਦੀ ਹਾਂ